ਮੇਰਾ ਨਾਮ ਨੈਨਸੀ ਹੈ ਸਾਡੇ ਸਕੂਲ 'ਚੋਂ ਅਧਿਆਪਕ ਬੱਚਿਆਂ ਨੂੰ ਸਾਇੰਸ ਸਿਟੀ ਲੈ ਕੇ ਗਏ ਸਨ ਉੱਥੇ ਬਹੁਤ ਹੀ ਸਿੱਖਣ ਨੂੰ ਮਿਲਦਾ ਹੈ ਸਾਇੰਸ ਸਿਟੀ ਬਹੁਤ ਹੀ ਵਧੀਆ ਜਗ੍ਹਾ ਹੈ ਉੱਥੇ ਕਲਪਨਾ ਚਾਵਲਾ ਦਾ ਵੀ ਇੱਕ ਰੋਬੋਟ ਬਣਿਆ ਹੋਇਆ ਹੈ ਅਤੇ ਉਸ ਵਿੱਚ ਉਸ ਦੀ ਤਸਵੀਰ ਵੀ ਹੈ ਅਤੇ ਉੱਥੇ ਬਹੁਤ ਸਾਰੇ ਡਾਇਨਾਸੋਰ ਅਤੇ ਬਹੁਤ ਹੀ ਸਾਰੀਆਂ ਮਸ਼ੀਨਾਂ ਹਨ ਉੱਥੇ ਕਈ ਸਾਇੰਟਿਸਟਾਂ ਦੇ ਬੁੱਤ ਵੀ ਸਨ ਅਤੇ ਉੱਥੇ ਬੋਲਣ ਵਾਲੇ ਡਾਇਨਾਸੋਰ ਵੀ ਸਨ ਉੱਥੇ ਬਹੁਤ ਕੁਝ ਸਿਖਾਇਆ ਜਾਂਦਾ ਹੈ ਕਿ ਇੱਥੇ ਸਿੱਖਣ ਨੂੰ ਬਹੁਤ ਕੁਝ ਸਨ ਸਾਇੰਸ ਸਿਟੀ ਬਹੁਤ ਹੀ ਵਧੀਆ ਜਗ੍ਹਾ ਹੈ ਉੱਥੇ ਘੁੰਮਣ ਨੂੰ ਬਹੁਤ ਥਾਵਾਂ ਹਨ ਸਾਇੰਸ ਸਿਟੀ ਵਿੱਚ ਥਰੀ ਡੀ ਸ਼ੋਅ ਅਤੇ ਥੀਏਟਰ ਵੀ ਹੈ ਸਾਨੂੰ ਇਹ ਟੂਰ ਸਕੂਲ ਵੱਲੋਂ ਲਿਜਾਇਆ ਜਾਂਦਾ ਹੈ